ਬਦਲਦੇ ਮੌਸਮ ਨਾਲ ਸਾਡੀ ਖੇਤੀ 'ਤੇ ਪ੍ਰਭਾਵ ਬਹੁਤ ਪੈਂਦਾ ਹੈ ਜਦੋਂ ਮੌਸਮ ਬਦਲਦਾ ਹੁੰਦਾ ਹੈ ਤਾਂ ਜਦੋਂ ਹੜ ਸੋਕਾ ਸਰਦੀਆਂ ਚੱਕਰਵਰਤੀ ਤੂਫਾਨ ਗੜ੍ਹੇ ਆ ਜਾਂਦੇ ਹਨ ਤਾਂ ਜੋ ਫਸਲਾਂ ਫਸਲ ਬੀਜੀ ਹੁੰਦੀ ਹੈ ਜਿਵੇਂ ਕਣਕ ਦੀ ਫਸਲ ਹੁੰਦੀ ਹੈ ਕਣਕ ਦਾ ਬੱਲੀ ਵਿੱਚੋਂ ਦਾਣਾ ਬਿਲਕੁਲ ਸੁੱਕ ਜਾਂਦਾ ਗਾ ਮਰ ਜਾਂਦਾ ਗਾ ਅਤੇ ਖਾ ਕਣਕ ਜੋ ਖਾਣ ਯੋਗ ਨਹੀਂ ਰਹਿੰਦੀ ਅਤੇ ਇਸ ਨਾਲ ਜੋ ਕਣਕ ਵਗੈਰਾ ਹੁੰਦੀ ਹੈ ਸਾਡੇ ਸਰੀਰ ਨੂੰ ਵੀ ਨੁਕਸਾਨ ਕਰਦੀ ਹੈ ਬਦਲਦੇ ਮੌਸਮ ਵਿੱਚ ਜੋ ਖਰਾਬ ਹੋਈ ਕਣਕ ਜਿਵੇਂ ਝੋਨਾ ਝੋਨਾ ਅੱਜ ਕੱਲ੍ਹ ਲੋਕ ਝੋਨਾ ਲਗਾ ਰਹੇ ਹਨ ਅਤੇ ਝੋਨੇ ਝੋਨਾ ਲਗਾਉਣ ਨਾਲ ਕਿ ਜਿਹੜਾ ਪਾਣੀ ਦਾ ਪੱਧਰ ਆ ਉਹ ਬਹੁਤ ਨੀਵਾਂ ਜਾ ਰਿਹਾ ਹੈ ਅਤੇ ਇਸ ਕਰਕੇ ਸਾਨੂੰ ਬਦਲਦੇ ਮੌਸਮ ਵਿੱਚ ਆਪਣੀਆਂ ਫਸਲਾਂ ਦਾ ਬਚਾਵ ਕਰਨ ਲਈ ਕਿਸਾਨ ਇਹਨਾਂ 'ਤੇ ਰੁਕਾਵਟਾਂ ਲਗਾ ਸਕਦੇ ਹਨ ਅਤੇ ਇਹ ਜੋ ਗੜੇ ਗ ਗੜਿਆਂ 'ਤੇ ਹਨੇਰੀਆਂ ਤੂਫਾਨਾਂ ਵਿੱਚ ਕਣਕ ਵਗੈਰਾ ਫਸਲ ਕੋਈ ਵੀ ਫਸਲ ਆ ਫਲ ਫਲ ਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਨੁਕਸਾਨ ਹੁੰਦਾ ਹੈਗਾ ਇਹ ਇਸ ਕਰਕੇ ਜੋ ਫਸਲਾਂ ਹੁੰਦੀਆਂ ਗੀਆਂ ਸਾਡੀ ਖੇਤੀ ਖੇਤੀ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ